ਸਤਿ ਸ਼੍ਰੀ ਅਕਾਲ ਮੇਰਾ ਨਾਂ ਸ਼ਵਨਾਸ਼ਾਦ ਹੈ ਮੈਂ ਤੁਹਾਨੂੰ ਪੰਜਾਬ ਦੇ ਇਤਿਹਾਸ ਵਿੱ ਬਾਰੇ ਦੱਸਣਾ ਚਾਹੁੰਦੀ ਹਾਂ ਪੰਜਾਬੀ ਭਾਸ਼ਾ ਦਾ ਪ੍ਰਚਾਰ ਗੁਰੂ ਨਾਨਕ ਦੇਵ ਜੀ ਨੇ ਕੀਤਾ ਸੀ ਉਹ ਇਸ ਭਾਸ਼ਾ ਦੇ ਸੰਸਥਾਪਕ ਸੀ ਉਹ ਚਾਹੁੰਦੇ ਸੀ ਕਿ ਪੰਜਾਬੀ ਭਾਸ਼ਾ ਦਾ ਪ੍ਰਚਾਰ ਹਰ ਜਗ੍ਹਾ ਜਗ੍ਹਾ 'ਤੇ ਹੋਵੇ ਪਰ ਜਦ ਤੱਕ ਮੁਗਲਾਂ ਦਾ ਰਾਜ ਸੀ ਪੰਜਾਬੀ ਭਾਸ਼ਾ ਦਾ ਕੋਈ ਮਹੱਤਵ ਨਹੀਂ ਸੀ ਜਦੋਂ ਦੋ ਮੁਗਲਾਂ ਦਾ ਸ਼ਾਸਨ ਖਤਮ ਹੋਇਆ ਅਤੇ ਅੰਗਰੇਜ਼ਾਂ ਦਾ ਸ਼ਾਸਨ ਸ਼ੁਰੂ ਹੋਇਆ ਤਾਂ ਪੰਜਾਬੀ ਭਾਸ਼ਾ ਵਿੱਚ ਕਈ ਸੁਧਾਰ ਕੀਤੇ ਗਏ ਗੁਰੂ ਨਾਨਕ ਦੇਵ ਜੀ ਚਾਹੁੰਦੇ ਸੀ ਕਿ ਪੰਜਾਬੀ ਭਾਸ਼ਾ ਨੂੰ ਉੱਚੇ ਪੱਧਰ 'ਤੇ ਬੋਲ ਬੋਲਿਆ ਬੋਲਿਆ ਜਾਵੇ ਤਾਂ ਜੋ ਸਾਰੇ ਲੋਕ ਪੰਜਾਬੀ ਬੋਲ ਸਕਣ ਪਰ ਜਿਵੇਂ ਜਿਵੇਂ ਸਮਾਂ ਵੱਧਦਾ ਗਿਆ ਪੰਜਾਬੀ ਭਾਸ਼ਾ ਦਾ ਪ੍ਰਚਾਰ ਘੱਟ ਹੁੰਦਾ ਗਿਆ ਕਿਉਂਕਿ ਲੋਕ ਜਿਹੜੇ ਸੀ ਉਹ ਚਾਹੁੰਦੇ ਸੀ ਕਿ ਉਹ ਅੰਗਰੇਜ਼ੀ ਭਾਸ਼ਾ ਨੂੰ ਜ਼ਿਆਦਾ ਮਹੱਤਵ ਦਿੰਦੇ ਸੀ ਉਹ ਪੰਜਾਬੀ ਨੂੰ ਕਮ ਪੰਜਾਬੀ ਭਾਸ਼ਾ ਨੂੰ ਕਮ ਮਹੱਤਵ ਦਿੰਦੇ ਸੀ ਉਹ ਜ਼ਿਆਦਾ ਤੋਂ ਜ਼ਿਆਦਾ ਅੰਗਰੇਜ਼ੀ ਬੋਲਦੇ ਸੀ ਕਿਉਂਕਿ ਸਾਨੂੰ ਕਿਤੇ ਵੀ ਜਾਣ ਲਈ ਅੰਗਰੇਜ਼ੀ ਦਾ ਆਉਣਾ ਬਹੁਤ ਜ਼ਰੂਰੀ ਹੈ ਪੰਜਾਬੀ ਭਾਸ਼ਾ ਦਾ ਮਹੱਤਵ ਘੱਟ ਹੁੰਦਾ ਗਿਆ ਅਤੇ ਅੰਗਰੇਜ਼ੀ ਦਾ ਮਹੱਤਵ ਵੱਧਦਾ ਗਿਆ ਇਸ ਕਾਰਨ ਪੰਜਾਬੀ ਸੱਭਿਆਚਾਰ ਵਿੱਚ ਪੰਜਾਬੀ ਭਾਸ਼ਾ ਦਾ ਮਹੱਤਵ ਘਟਦਾ ਗਿਆ ਅਤੇ ਅੰਗਰੇਜ਼ੀ ਭਾਸ਼ਾ ਦਾ ਮਹੱਤਵ ਵੱਧਦਾ ਗਿਆ